ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਕੰਪਨੀ ਦੀ ਸਿਮ ਯੂਜ ਕਰਦਾ ਹਾਂ ਅਤੇ ਕੱਲ੍ਹ ਰਾਤ ਨੂੰ ਮੇਰਾ ਉਸ ਉੱਤੇ ਇੰਟਰਨੈੱਟ ਦਾ ਅਤੇ ਕੋਲਿੰਗ ਦਾ ਪਲੈਨ ਖਤਮ ਹੋ ਚੁੱਕਿਆ ਸੀਗਾ ਅਤੇ ਪਰ ਮੈਂ ਉਸ ਦੇ ਉੱਤੇ ਆਪ ਖੁਦ ਹੀ ਇੱਕ ਰਕਮ ਭਰ ਕੇ ਰਿਚਾਰਜ ਕਰ ਬੈਠਾ ਪਰ ਉਹ ਜਿਹੜਾ ਰਿਚਾਰਜ ਸੀਗਾ ਕਿਸੇ ਵੀ ਪਲੈਨ ਦੇ ਵਿੱਚ ਸ਼ਾਮਿਲ ਨਹੀਂ ਸੀਗਾ ਉਹ ਕਿਸੇ ਵੀ ਪਲੈਨ ਦੇ ਵਿੱਚ ਸ਼ਾਮਿਲ ਨਾ ਹੋਣ ਕਰਕੇ ਉਸ ਦੇ ਉੱਤੇ ਸਾਰੀਆਂ ਹੀ ਜਿਹੜੀ ਸੇਵਾਵਾਂ ਕੋਈ ਵੀ ਲਾਗੂ ਨਹੀਂ ਹੋਈ ਨਾ ਉਸ 'ਤੇ ਇੰਟਰਨੈੱਟ ਚੱਲ ਰਿਆ ਅਤੇ ਨਾ ਹੀ ਉਸ 'ਤੇ ਕੋਲਿੰਗ ਹੋ ਰਹੀ ਆ ਕਿਰਪਾ ਕਰਕੇ ਉਸ ਨੂੰ ਕਿਸੇ ਵੀ ਦੂਸਰੇ ਚਾਰਜ ਦੇ ਵਿੱਚ ਤਬਦੀਲ ਕਰਕੇ ਉਸਨੂੰ ਇੰਟਰਨੈੱਟ ਅਤੇ ਕੋਲਿੰਗ ਦੀ ਸੇਵਾ ਵਿੱਚ ਤਬਦੀਲ ਕੀਤਾ ਜਾਵੇ ਹਾਂ ਆਪ ਆਪ ਨੂੰ ਇਸ ਦੇ ਬਾਰੇ ਕੋਈ ਵੀ ਵੈਰੀਫਿਕੇਸ਼ਨ ਕੁਝ ਵੀ ਓ ਟੀ ਪੀ ਚਾਹੀਦਾ ਹੋਵੇਗਾ ਅਤੇ ਮੈਂ ਉਹ ਆਪ ਨੂੰ ਪ੍ਰਦਾਨ ਕਰ ਦਿਆਂਗਾ ਜੀ ਜੀ ਤੁਹਾਡੇ ਵਲੋਂ ਬਹੁਤ ਧੰਨਵਾਦ ਹੋਵੇਗਾ ਪਲੀਜ਼ ਇਸ ਨੂੰ ਜਲਦੀ ਤੋਂ ਜਲਦੀ ਤਬਦੀਲ ਕਰ ਦਿੱਤਾ ਜਾਵੇ ਜੀ ਥੈਂਕਿ ਊ ਸੋ ਮੱਚ